ਹੈਲੋ ਸਰ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਡੇ ਕੋਲ ਦੇਖੋ ਜੀ ਜਿਵੇਂ ਹੁਡੀ ਹੋ ਗਿਆ ਕੋਟ ਹੈਗੀ ਜੈਕਟ ਹੈਗੀ ਕੋਟ ਕੋਟੀ ਨਹੀਂ ਹੁੰਦੀ ਪਾਉਣ ਵਾਲੀ ਉਸ ਤਰ੍ਹਾਂ ਦੇ ਸਾਰੇ ਕੱਪੜੇ ਸਰਦੀਆਂ ਦੇ ਜਿੰਨੇ ਵੀ ਮਨਲੋ ਪਾਉਣ ਵਾਲੇ ਕੱਪੜੇ ਸਰ ਸਾਰੇ ਐਵੇਟੇਬਟ ਹੈਗੇ ਹੈ ਹਾਂਜੀ ਬੱਚਿਆਂ ਦੇ ਲੇਡੀਜ਼ ਦੇ ਜੈਂਟਸ ਦੇ ਜਿਨ ਜਿੰਨੇ ਮਰਜ਼ੀ ਕੱਪੜੇ ਲਓ ਸਰ ਹਾਂਜੀ ਹਾਂਜੀ ਸਾਰਿਆਂ ਦੇ ਬਟ ਕੱਪੜੇ ਮਿਲ ਜਾਣਗੇ ਜੀ ਹੋਲਸੇਲ ਰੇਟ ਹੈ ਹਾਂਜੀ ਸਰ ਹਾਂਜੀ ਹਾਂਜੀ ਸਾਰਾ ਕੁਝ ਜਰੋਕਸ ਹੋ ਗਿਆ ਜਿਵੇਂ ਬਨੈਣ ਹੋਗੇ ਅੰਡਰਵੀਅਰ ਹੋ ਗਿਆ ਸਾਰਾ ਕੁਝ ਹਾਂਜੀ ਹਾਂਜੀ ਨਹੀਂ ਸਰ ਸਾਡੇ ਕੋਲ ਦਿੱਲੀ ਦਾ ਮਾਲ ਆਉਂਦਾ ਸਰ ਇੱਕ ਨੰਬਰ ਪਿਓਰ ਕੁਆਲਿਟੀ ਦਾ ਮਾਲ ਆਉਂਦਾ ਸਰ ਸਾਡੇ ਕੋਲ ਸਰ ਦੇਸੀ ਮਾਲ ਵੀ ਹੈਗਾ ਅਤੇ ਕੰਪਨੀ ਦਾ ਮਾਲ ਵੀ ਹੈਗਾ ਸਰ ਸਾਡੇ ਕੋਲ ਐਡੀਡਸ ਏਕ ਦੀਆਂ ਹੈਗਾ ਅਤੇ ਹੋਰ ਵੀ ਕਈ ਕੰਪਨੀਆਂ ਹੈਗੀਆਂ ਸਰ ਹਾਂਜੀ ਹਾਂਜੀ ਅਲੱਗ ਅਲੱਗ ਪ੍ਰਾਈਜ਼ ਹੈਗੇ ਸਾਰੀਆਂ ਕੰਪਨੀਆਂ ਦੇ ਸਰ ਸਰ ਜਿਵੇਂ ਤੁਸੀਂ ਲੇਡੀਜ਼ ਕੋਟੀ ਲਓਗੇ ਤਾਂ ਸਾਡੇ ਕੋਲ ਸਰ ਪੰਜ ਸੌ ਤੋਂ ਸ਼ੁਰੂ ਹੁੰਦੀ ਹੈ ਸਰ ਕੋਟੀ ਪੰਜ ਸੌ ਤੋਂ ਲੈ ਕੇ ਪੰਦਰ੍ਹਾਂ ਤੱਕ ਪੰਦਰ੍ਹਾਂ ਸੌ ਹਜ਼ਾਰ ਜਿੰਨੀ ਤੁਹਾਡੀ ਇੱਛਾ ਸਰ ਉਸੇ ਤਰ੍ਹਾਂ ਦਾ ਸਰ ਦੇਖੋ ਜਿੰਨੇ ਤੁਸੀਂ ਪੈਸੇ ਦਿਓਗੇ ਸਰ ਉਨਾਂ ਹੀ ਵਧੀਆ ਮਾਲ ਤੁਹਾਨੂੰ ਮਿਲੇਗਾ ਅਤੇ ਮੈਨੂੰ ਪਤਾ ਸਰ ਵੀ ਹਾਂਜੀ ਹਾਂਜੀ ਸਰ ਉਹ ਤਾਂ ਤੁਹਾਨੂੰ ਵੀ ਪਤਾ ਸਰ ਜਿੰਨਾ ਗੁੜ ਪਾਉਣਾ ਉਨਾ ਹੀ ਮਿੱਠਾ ਹੋਵੇਗਾ ਜਿੰਨਾ ਤੁਸੀਂ ਪੈਸੇ ਲਾਓਗੇ ਉਨਾ ਹੀ ਵਧੀਆ ਮਾਲ ਮਿਲੇਗਾ ਤੁਹਾਨੂੰ ਬਾਕੀ ਮਾਲ ਦੀ ਜਿਹੜੀ ਗਰੰਟੀ ਹੈ ਸਰ ਪੂਰਾ ਸਾਧ ਪੂਰਾ ਸਾਲ ਕੀ ਪੰਜ ਛੇ ਸਾਲ ਹੀ ਦੇਖਣੇ ਦੀ ਲੋੜ ਨਹੀਂ ਸਰ ਹਾਂਜੀ ਇੱਕ ਵਾਰੀ ਇੱਕ ਵਾਰੀ ਸਾਡੇ ਕੋਲ ਆਓਗੇ ਸਰ ਵਾਰ ਵਾਰ ਤੁਸੀਂ ਆਓਗੇ ਅਤੇ ਨਾਲੇ ਆਪਣੇ ਮਿੱਤਰ ਦੋਸਤਾਂ ਨੂੰ ਵੀ ਦੱਸੋ ਵੀ ਉੱਥੋ ਕੱਪੜੇ ਲੈ ਕੇ ਆਉਣੇ ਹੈ ਸਰਦੀਆਂ ਦੇ ਹਾਂਜੀ ਹਾਂਜੀ ਹਾਂਜੀ ਹਾਂਜੀ ਲੇਡੀਜ਼ ਕੇਪ ਹੈਗੀ ਹੈ ਔਰ ਜੈਂਟਸ ਵੀ ਹੈਗੀ ਹੈ ਬੱਚਿਆਂ ਦੀ ਕੈਪ ਵੀ ਹੈਗੀ ਹੈ ਅਤੇ ਬੱਚਿਆਂ ਦੇ ਸਰ ਦੇਖੋ ਅਲੱਗ ਅਲੱਗ ਕੇਪ ਦੇ ਅਲੱਗ ਅਲੱਗ ਪ੍ਰਾਈਜ਼ ਹੈਗੇ ਹੈ ਜਿਵੇਂ ਤੁਸੀਂ ਸਿੰਪਲ ਲੈਣੀ ਤਾਂ ਸੌ ਰੁਪਏ ਦੀ ਮਿਲ ਜੂਗੀ ਅਤੇ ਹੋਰ ਥੋੜ੍ਹੀ ਫੈਸ਼ਨੇਬਲ ਲੈਣੀ ਹੈ ਤਾਂ ਦੋ ਸੌ ਤਿੰਨ ਸੌ ਪੰਜ ਸੌ ਤੱਕ ਦੀ ਕੇਪ ਹੈਗੀ ਸਰ ਸਾਡੇ ਕੋਲ ਹਾਂਜੀ ਹਾਂਜੀ ਇਹ ਤੂੰ ਤੁਸੀਂ ਸਲੈਕਟ ਕਰਨਾ ਸਰ ਕਿਹੜੀ ਲੈਣੀ ਹੈ ਗਲਬਸ ਵੀ ਹੈਗੇ ਹੈ ਸਰ ਗਲਬਸ ਵੀ ਹੈਗੇ ਹੈ ਹਾਂਜੀ ਗੋ ਗਲਬਸ ਸਰ ਵੀ ਹੈਗੇ ਹੈ ਅਤੇ ਵਾਟਰ ਪਰੂਫ ਵੀ ਹੈਗੇ ਹੈ ਸਰ ਹਾਂਜੀ ਹਾਂਜੀ ਦੋਨੋਂ ਚੂਜ਼ ਕਰ ਚੂਜ਼ ਕਰ ਸਕਦੇ ਕਿਉਂਕਿ ਸਰ ਸਾਈਜ਼ ਦਾ ਥੋੜ੍ਹਾ ਬਹੁਤ ਈ ਫਰਕ ਹੁੰਦਾ ਸਰ ਅਡਜਸਟ ਹੋ ਜਾਂਦਾ

ਹਾਂਜੀ ਹਾਂਜੀ ਬੱਚਿਆਂ ਦੇ ਗਲਬਸ ਮਿਲ ਜਾਣਗੇ ਬੱਚਿਆਂ ਦੇ ਜਰੋਕਸ ਵੀ ਮਿਲ ਜਾਣਗੇ ਜਰਾਬਾਂ ਵਗੈਰਾ ਹਾਂਜੀ ਸਾਡੀ ਸਾਡਾ ਐ ਐਡਰੈਸ ਹੈ ਜੀ ਗਊਸ਼ਾਲਾ ਰੋਡ 'ਤੇ ਆਪਣੀ ਸ਼ੋਪ ਹੈਗੀ ਹੈ ਸਰ ਹਾਂਜੀ ਹਾਂਜੀ ਵਿੰਟਰ ਸ਼ੋਪ ਅਸ਼ੋਕ ਵਾਟਿਕਾ ਹਾਂਜੀ ਹਾਂਜੀ ਹਾਂਜੀ ਥੈਂਕ ਯੂ ਸਰ ਥੈਂਕ ਯੂ